ਹਾਂਜੀ ਟੈਕਨੋਲਜੀ ਦੇ ਆਉਣ ਨਾਲ ਬਿਜਲੀ ਦੀ ਖਪਤ ਵਿੱਚ ਬਹੁਤ ਸਾਰਾ ਵਾਧਾ ਹੋਇਆ ਹੈ ਜਿਸ ਨਾਲ ਬਿਜਲੀ ਖਪਤਕਾਰਾਂ ਬਹੁਤ ਵਧ ਰਹੇ ਹਨ ਇਸ ਨਾਲ ਬਿਜਲੀ ਦੀ ਬਹੁਤ ਘਾਟ ਹੋ ਰਹੀ ਹੈ ਅਤੇ ਬਿਜਲੀ ਦੇ ਬਹੁਤ ਸਾਰੇ ਪਲਾਂਟ ਬੰਦ ਹੋ ਰਹੇ ਹਨ ਜੋ ਕਿ ਬਿਜਲੀ ਬਣਾਉਂਦੇ ਸੀ ਇਸ ਲਈ ਹੁਣ ਸਾਨੂੰ ਬਹੁਤ ਹੀ ਸਹੀ ਢੰਗ ਨਾਲ ਬਿਜਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਸਾਨੂੰ ਘਰਾਂ ਵਿੱਚ ਬਿਜਲੀ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ ਨਹੀਂ ਤਾਂ ਬਿਜ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਜਾਣਗੀਆਂ ਸਾਨੂੰ ਘਰਾਂ ਵਿੱਚ ਲੋੜ ਅਨੁਸਾਰ ਹੀ ਬਿਜਲੀ ਦੀ ਵਰਤਣੀ ਚਾਹੀਦੀ ਹੈ ਜਿਵੇਂ ਕਿ ਘਰਾਂ ਦੇ ਵਿੱਚ ਕੂਲਰ ਬਾਲਬ ਏਸੀ ਏਅਰ ਕੰਡੀਸ਼ਨ ਫਰਿੱਜ ਆਦਿ ਵਰਤੋਂ ਸਮੇਂ ਅਤੇ ਸਹੀ ਟਾਈਮ 'ਤੇ ਹੀ ਕਰਨੀ ਚਾਹੀਦੀ ਹੈ ਸਾਨੂੰ ਘਰਾਂ ਵਿੱਚ ਬਿਜਲੀ ਦੀ ਵਰਤੋਂ ਲੋੜ ਅਨੁਸਾਰ ਅਤੇ ਲੋੜ ਪੈਣ 'ਤੇ ਹੀ ਕਰਨੀ ਚਾਹੀਦੀ ਹੈ ਅਤੇ ਇਸ ਦਾ ਇੱਕ ਹੋਰ ਸੁਝਾਅ ਹੈ ਬਿਜਲੀ ਬਚਾਉਣ ਲਈ ਸਾਨੂੰ ਘਰਾਂ ਵਿੱਚ ਸੋਲਰ ਸਿਸਟਮ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬਿਜਲੀ ਬਚ ਜਾਵੇ ਅਤੇ ਘਰਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੋਲਰ ਸੀਟਰ ਲਗਵਾਏ ਜਾਣ ਜਿਸ ਨਾਲ ਬਿਜਲੀ ਦੀ ਖਪਤਕਾਰ ਘੱਟ ਹੋ ਜਾਵੇ ਤਾਂ ਜੋ ਸਾਡਾ ਆਉਣ ਵਾਲਾ ਸਮਾਂ ਬਹੁਤ ਹੀ ਚੰਗਾ ਰਹੇ ਅਤੇ ਬਿਜਲੀ ਚੰਗੀ ਤਰ੍ਹਾਂ ਪ੍ਰਾਪਤ ਹੁੰਦੀ ਰਹੇ